ਹਾਂਜੀ ਅੱਜ ਤੋਂ ਵੀਹ ਸਾਲ ਪਹਿਲਾਂ ਨਾ ਸਾਡੇ ਕਿ ਆਮ ਸਾਰੇ ਪਿੰਡਾਂ ਦੇ ਵਿੱਚ ਜਿਹੜੇ ਪਖਾਨਾ ਇਹਦੇ ਨਾ ਲੋਕ ਖੁੱਲੇ ਵਿੱਚ ਹੀ ਜਾਂਦੇ ਸੀਗੇ ਅਤੇ ਉਦੋਂ ਇੱਕ ਤਾਂ ਗਰੀਬੀ ਕਰਕੇ ਦੇਖੋ ਟੋਇਲੇਟ ਵਗੈਰਾ ਦਾ ਪ੍ਰਬੰਧ ਨਹੀਂ ਉਹ ਕਰ ਸਕਦੇ ਸੀਗੇ ਅਤੇ ਬਸ ਇੱਕ ਉਹਨਾਂ ਦੇ ਸੁਭਾਅ ਹੀ ਇਹੋ ਜਿਹੇ ਸੀ ਲੋਕਾਂ ਦੇ ਵੀ ਖੁੱਲੇ ਜਿਹੇ ਸੁਭਾਅ ਵਾਲੇ ਸੀ ਵੀ ਖੁੱਲੇ 'ਚ ਜਾਣਾ ਉਹਨਾਂ ਨੂੰ ਬਹੁਤ ਵਧੀਆ ਵੀ ਚੰਗਾ ਲੱਗਦਾ ਹੋਉ ਉਹਨਾਂ ਨੂੰ ਚੰਗਾ ਲੱਗਦਾ ਸੀਗਾ ਅਤੇ ਪਰ ਜਿਉਂ ਜਿਉਂ ਜਿਹੜੇ ਸਿੱਖਿਆ ਦੇ ਪਸਾਰ ਹੋਇਆ ਤਾਂ ਲੋਕਾਂ ਦੀ ਜਿਹੜੀ ਸੋਚ ਹੈ ਉਹ ਵੀ ਬਦਲਣ ਲੱਗੀ ਹੈ ਨਾ ਅਤੇ ਉਹ ਜਿਹੜਾ ਕੀ ਆ ਬੀ ਉਹ ਸੋਚ ਬਦਲੀ ਇਹ ਸੋਚ ਤਾਂ ਹੀ ਬਦਲੀ ਜਦੋਂ ਉਹਨਾਂ ਨੂੰ ਪੜ੍ਹ ਕੇ ਉਹਨਾਂ ਨੂੰ ਇਹ ਪਤਾ ਲੱਗਣ ਲੱਗਿਆ ਵੀ ਕਿੰਨੀ ਅਸੀਂ ਗੰਦਗੀ ਅਸੀਂ ਖਿਲਾਰਦੇ ਹਾਂ ਨਾ ਉਸ ਗੰਦਗੀ ਦੇ ਉੱਪਰ ਮੱਖੀਆਂ ਬਹਿੰਦੀਆਂ ਨੇ ਮੱਖੀਆਂ ਉੱਡ ਕੇ ਦੇਖੋ ਸਾਡੀਆਂ ਖਾਣ ਵਾਲੀਆਂ ਚੀਜ਼ਾਂ ਤੀਕਰ ਆ ਕੇ ਪਹੁੰਚਦੀਆਂ ਨੇ ਹੈ ਨਾ ਅਤੇ ਉਸ ਤੋਂ ਬਾਅਦ ਜਿਹੜੇ ਉਹ ਕੀਟਾਣੂ ਉੱਥੋਂ ਲੈ ਕੇ ਆਉਂਦੀਆਂ ਨੇ ਉਸ ਗੰਦਗੀ ਤੋਂ ਉਹ ਸਾਡੇ ਖਾਣੇ ਉੱਪਰ ਆ ਕੇ ਬਹਿੰਦੀਆਂ ਨੇ ਅਤੇ ਉਹ ਹੀ ਖਾਣਾ ਅਸੀਂ ਖਾਨੇ ਐ ਜਿਹਦੇ ਨਾਲ ਸਾਨੂੰ ਬਿਮਾਰੀਆਂ ਲੱਗਦੀਆਂ ਹੈਗੀਆਂ ਠੀਕ ਹੈ ਨਾ ਅਤੇ ਹੌਲੀ ਹੌਲੀ ਇਹ ਚੀਜ਼ਾਂ ਨਾਂ ਦੂਰ ਹੋਣ ਲੱਗ ਗਈਆਂ ਅਤੇ ਹੁਣ ਤਾਂ ਦੇਖੀਏ ਪਿੰਡਾਂ ਦੇ ਵਿੱਚ ਦੇਖੀਏ ਹੁਣ ਇੱਦਾਂ ਦਾ ਕੋਈ ਸਿਸਟਮ ਨਹੀਂ ਵੀ ਇੱਕ ਅੱਧਾ ਕੋਈ ਜੇ ਬਜ਼ੁਰਗ ਹੈ ਕੋਈ ਪੁਰਾਣੇ ਵਿਚਾਰ ਦਾ ਉਹੀ ਜਾਂਦਾ ਅਦਰਵਾਈਜ਼ ਮੈਂ ਤਾਂ ਨਹੀਂ ਹੁਣ ਕਦੇ ਇੱਥੇ ਦੇਖਿਆ ਸਾਡੇ ਪਿੰਡ ਦੇ ਵਿੱਚ ਕੋਈ ਪਖਾਨਾ ਵੀ ਬਾਹਰ ਜਾਂਦਾ ਹੋਊਗਾ ਕਿਉਂਕਿ ਲੋਕ ਹੁਣ ਸਮਝ ਗਏ ਵੀ ਇਹਦੇ ਕੀ ਕੀ ਨੁਕਸਾਨ ਆ ਹੈ ਨਾ ਦੇਖੋ ਪਹਿਲਾਂ ਬਹੁਤੇ ਜਾਂਦੇ ਸੀ ਮੈਂ ਤੁਹਾਨੂੰ ਦੱਸਿਆ ਵੀ ਵੀਹ ਸਾਲ ਪਹਿਲਾਂ ਤਾਂ ਦੇਖੋ ਬਹੁਤ ਲੋਕ ਖੁੱਲੇ 'ਚ ਹੀ ਜਾਂਦੇ ਸੀਗੇ ਅਤੇ ਪਰ ਹੁਣ ਜਿਹੜਾ ਕਿ ਇਹ ਬੰਦੇ ਵੀ ਬੁੜੀਆਂ ਵੀ ਸਾਰੇ ਬਾਹਰ ਹੀ ਜਾਂਦੇ ਹਰ ਬੰਦਿਆਂ ਦੇ ਹੱਥ 'ਚ ਬੋਤਲਾਂ ਫੜੀਆਂ ਹੁੰਦੀਆਂ ਅਤੇ ਬੁੜੀਆਂ ਦੇ ਹੱਥ 'ਚ ਗੜਵੀਆਂ ਪਾਣੀ ਦੀਆਂ ਫੜੀਆਂ ਉਹ ਸਾਰੀਆਂ ਲੇਡੀਜ਼ ਟੋਲੀ ਬਣਾ ਕੇ ਜਾਂਦੀਆਂ ਨੇ ਫਿਰ ਉਹ ਬਹਿੰਦੀਆਂ ਅਤੇ ਪਰ ਉਹ ਜਿਹੜੇ ਕਿ ਹੈ ਸ਼ਰਮ ਮਹਿਸੂਸ ਜਿਉਂ ਜਿਉਂ ਵੀ ਕਹਿੰਦੇ ਸਿੱਖਿਆ ਦਾ ਪ੍ਰਸਾਰ ਹੋਇਆ ਅਤੇ ਗੜਵੀ ਚੱਕ ਕੇ ਜਾਣ ਦੇ ਵਿੱਚ ਵੀ ਸ਼ਰਮ ਆਉਣ ਲੱਗੀ ਉਹਨਾਂ ਨੂੰ ਅਤੇ ਕਿਉਂਕਿ ਜਿਹੜੀ ਬੇਟੀ ਜਾਂ ਬਹੂ ਆ ਜਾਂ ਇਹ ਵੀ ਇੱਜਤ ਆਪਣੀ ਹੁੰਦੀ ਹੈ ਨਾ ਘਰ ਦੀ ਫਿਰ ਉਹ ਸਮਝ ਆਉਣ ਲੱਗ ਗਈ ਵੀ ਸਾਰੀਆਂ ਚੀਜ਼ਾਂ ਵੀ ਅੰਦਰ ਹੀ ਹੋਣੀਆਂ ਚਾਹੀਦੀਆਂ ਨੇ ਕਿਉਂ ਜਿਹੜੀ ਲੜਕੀ ਹੈ ਬਾਹਰ ਜਾਵੇ ਹੈ ਨਾ ਇਹ ਕੰਮ ਜਿਹੜੇ ਚਲੋ ਉਹ ਤਾਂ ਚੀਜ਼ ਹੈਗੀ ਹੈਗੀ ਹੈ ਨਾਲ ਫਿਰ ਮੈਂ ਗੰਦਗੀ ਵੀ ਫੈਲਦੀ ਸੀ ਨਾ ਅਤੇ ਉਹ ਵੀ ਮੱਖੀਆਂ ਦੇ ਨਾਲ ਆਪਣਾ ਉਹ ਚੇਂਜ ਬਣ ਜਾਂਦੀ ਹੈ ਨਾ ਵੀ ਉਹ ਆਪਣੀ ਗੰਦਗੀ ਉਹ ਮੱਖੀਆਂ ਆਪਣੇ ਘਰੇ ਫਿਰ ਲਿਆਉਂਦੀਆਂ ਸੀਗੀਆਂ ਤਾਂ ਇਹਦੇ ਬਹੁਤ ਜ਼ਿਆਦਾ ਨੁਕਸਾਨ ਹੈਗੇ ਹੀ ਹੈਗੇ ਤਾਂ ਹੁਣ ਜਿਹੜੇ ਲੋਕਾਂ ਦੀ ਸੋਚ ਬੜਾ ਬਦਲ ਰਹੀ ਹੈ ਬਹੁਤ ਵਧੀਆ ਗੱਲ ਹੈ ਅਤੇ ਜਿਹੜਾ ਪਖਾਨਾ ਤਾਂ ਆਪਾਂ ਨੂੰ ਜਿਹੜਾ ਕੀ ਆ ਜੋ ਸੀਟ ਲਗਾ ਕੇ ਆਪਣੇ ਅੰਦਰ ਬਣਿਆ ਪਿਆ ਹੁੰਦਾ ਹੈਗਾ ਉੱਥੇ ਹੀ ਜਾਣਾ ਚਾਹੀਦਾ ਅਤੇ ਉਸ ਪਖਾਨੇ ਦੀ ਸਾਨੂੰ ਉਸ ਦੀ ਵੀ ਪ੍ਰੋਪਰ ਸਫਾਈ ਕਰਨੀ ਚਾਹੀਦੀ ਹੈ ਡੇਲੀ ਸਾਨੂੰ ਆਪਣਾ ਫਨੈਲ ਵਗੈਰਾ ਦੇ ਨਾਲ ਧੋ ਕੇ ਹਾਰਪਿਕ ਦੇ ਨਾਲ ਧੋ ਕੇ ਉਹਨੂੰ ਰੱਖਣਾ ਚਾਹੀਦਾ ਹੈਗਾ ਕਿਉਂਕਿ ਚਲੋ ਅੱਗੇ ਤਾਂ ਅਸੀਂ ਬਾਹਰ ਕਰਕੇ ਹੁੰਦੇ ਸੀ ਬਾਹਰੋਂ ਮੱਖੀਆਂ ਆਉਂਦੀਆਂ ਸੀ ਹੁਣ ਤਾਂ ਅਸੀਂ ਆਪਦੇ ਘਰਾਂ 'ਚ ਹੀ ਕਰਦੇ ਹਾਂ ਗੇ ਅਤੇ ਉੱਥੋਂ ਮੱਖੀ ਆਉਣ ਦਾ ਰਸੋਈ ਤੀਕਰ ਤਾਂ ਦੋ ਚਾਰ ਸਕਿੰਟ ਵੀ ਨਹੀਂ ਲੱਗਣੇ ਹੈ ਨਾ ਤਾਂ ਜਿਹੜੀ ਆਪਣੇ ਘਰੇ ਵੀ ਟੋਇਲਟ ਹੈ ਆਪਣੀ ਸੀਟ ਲੱਗੀ ਹੋਈ ਹੈ ਉਹਨੂੰ ਵੀ ਚੰਗੀ ਤਰ੍ਹਾਂ ਦੇ ਨਾਲ ਆਪਾਂ ਨੂੰ ਸਾਫ ਕਰਨਾ ਚਾਹੀਦਾ ਹੈਗਾ ਹੈ ਨਾ ਨੁਕਸਾਨ ਇਹਦੇ ਬਹੁਤ ਜ਼ਿਆਦਾ ਗੇ ਅਤੇ ਠੀਕ ਹੈ ਜੀ ਓਕੇ